ਹੈਲੋ ਸਰ ਫਿਲਿਪਕਾਰਟ ਤੋਂ ਗੱਲ ਕਰ ਰਹੇ ਹੋ ਨਾ ਮੈਂ ਰੁਪਿੰਦਰ ਗੱਲ ਕਰ ਰਹੀ ਹਾਂ ਮੈਂ ਤੁਹਾਡੇ ਤੋਂ ਨਾ ਇੱਕ ਬੋਰੋਸਿਲ ਦੇ ਗਲਾ ਗਲਾਸ ਔਡਰ ਕੀਤੇ ਹੈਗੇ ਸੀਗੇ ਅਤੇ ਮੈਂ ਅੱਗੇ ਵੀ ਤੁਹਾਡੇ ਤੋਂ ਬਹੁਤ ਸਾਰੇ ਪ੍ਰੋਡਕਟ ਕਿਚਨ ਵੇਅਰ ਵਾਲੇ ਕੀਤੇ ਹੈਗੇ ਆ ਬਹੁਤ ਵਧੀਆ ਆਏ ਆ ਅਤੇ ਮੇਰੇ ਘਰ ਇੱਕ ਫੰਕਸ਼ਨ ਰੱਖਿਆ ਹੋਇਆ ਸੀਗਾ ਅਤੇ ਤਾਂ ਕਰਕੇ ਮੈਂ ਤੁਹਾਡੇ ਤੋਂ ਬੋਰੋਸਿਲ ਦੇ ਗਲਾਸ ਔਡਰ ਕਰ ਲਏ ਅਤੇ ਮੈਂ ਕਰ ਵੀ ਜ਼ਿਆਦਾ ਕੁਆਂਟੀਟੀ 'ਚ ਲਏ ਵੀ ਚਲ ਪਾਰਟੀ 'ਚ ਸਾਰਿਆਂ ਕੋਲ ਇੱਕੋ ਜਿਹੇ ਜ਼ਿਆਦਾ ਸੋਹਣੇ ਲੱਗਦੇ ਹੈਗੇ ਅਤੇ ਪਰ ਐਤਕੀ ਮੈਨੂੰ ਬਹੁਤ ਨਿਰਾਸ਼ਾ ਹੋਈ ਆ ਤੁਹਾਡੇ ਤੋਂ ਉਹ ਪ੍ਰੋਡਕਟ ਜਦੋਂ ਰਿਸੀਵ ਕੀਤਾ ਇੱਕ ਤਾਂ ਉਹਦੀ ਪੈਕਿੰਗ ਇੰਨੀ ਗੰਦੀ ਸੀ ਦੇਖਣ 'ਚ ਇੰਨੀ ਭੱਦੀ ਫਟਿਆ ਫਟਿਆ ਉੱਪਰ ਕਾਗਜ਼ ਹੈਗਾ ਸੀਗਾ ਥਰਮੋਕੋਲ ਤਾਂ ਵਿੱਚੋਂ ਸਾਰਾ ਫਟਿਆ ਹੋਇਆ ਸੀਗਾ ਅਤੇ ਹੁਣ ਉਹਦੇ 'ਚ ਜ ਜਦੋਂ ਦੇਖਿਆ ਉਹ 'ਚੋਂ ਦੋ ਗਲਾਸ ਬਰੇਕ ਹੈਗੇ ਸੀ ਇੱਕ 'ਚ ਨੀਚੇ ਤਰੇੜ ਆਈ ਹੋਈ ਸੀਗੀ ਅਤੇ ਮੈਨੂੰ ਬਹੁਤ ਇੰਬੈਰਸਮੈਂਟ ਫੀਲ ਹੋਈ ਇੱਕ ਮਿਲਿਆ ਵੀ ਜਮਾਂ ਪਾਰਟੀ ਵਾਲੇ ਦਿਨ ਹੀ ਹੈਗਾ ਫਿਰ ਮੈਨੂੰ ਘਰੋਂ ਅੱਡ ਅੱਡ ਦੇ ਗਲਾਸਾਂ ਨਾਲ ਹੀ ਪਾਰਟੀ 'ਚ ਕੰਮ ਚਲਾਉਣਾ ਪਿਆ ਹੈਗਾ ਹੁਣ ਤੁਸੀਂ ਦੱਸੋ ਕੀ ਫਾਇਦਾ ਨਿਕਲਿਆ ਮੈਨੂੰ ਆਪਣੇ ਪੈਸੇ ਲਾਉਣ ਦਾ ਤੁਹਾਡੇ ਪ੍ਰੋਡਕਟ ਤੋਂ ਬਹੁਤ ਅਸੀਂ ਡਿਸਪੋਇੰਟ ਹੋਏ ਹਾਂ ਐਤਕੀ ਥੈਂਕ ਯੂ